ਹਾਂਜੀ ਅਸੀਂ ਇੱਕ ਆਮ ਭੰਗੜਾ ਐਰੋਬਿਕ ਦੇ ਮੁਕਾਬਲੇ ਫ਼ਾਰਮੈਟ ਦਾ ਵਰਣਨ ਕਰ ਸਕਦੇ ਹਾਂ ਜਿਸ ਵਿੱਚ ਵੱਖ ਵੱਖ ਸ਼੍ਰੇਣੀਆਂ ਦੀਆਂ ਦੌਰ ਸ਼ਾਮਿਲ ਹੁੰਦੇ ਹਨ ਹੁੰਦੀਆਂ ਹਨ ਇਸ ਕਿਉਂਕਿ ਜਿੱਦਾਂ ਦੇਖੋ ਅੱਜ ਪਹਿਲੇ ਟਾਈਮ 'ਤੇ ਭੰਗੜਾ ਇੱਕ ਆਮ ਬਸ ਭੰਗੜੇ ਦੇ ਤੌਰ 'ਤੇ ਹੀ ਸਕੂਲਾਂ ਵਿੱਚ ਪਾਰਟੀਸਪੇ ਸਕੂਲਾਂ ਵਿੱਚ ਭਾਗ ਲੈਂਦੇ ਸਨ ਬੱਚੇ ਆਪਸ ਵਿੱਚ ਰਲ ਕੇ ਅਤੇ ਭੰਗੜਾ ਪਾਉਂਦੇ ਸਨ ਅੱਜ ਕੱਲ੍ਹ ਭੰਗੜੇ ਨੂੰ ਭੰਗੜਾ ਐਰੋਬਿਕ ਦਾ ਵੀ ਨਾਮ ਦਿੱਤਾ ਗਿਆ ਹੈ ਕਿਉਂਕਿ ਉਹ ਇਸ ਕਰਕੇ ਕਿ ਬੱਚਿਆਂ ਨੇ ਅੱਜ ਕੱਲ੍ਹ ਨਵੇਂ ਜ਼ਮਾਨੇ ਦੇ ਨਾਲ ਇੰਨੇ ਨਵੇਂ ਇਹਨਾਂ ਦੇ ਸਿਖਾਉਣ ਵਾਲੇ ਮਾਹਰ ਜਿਹੜੇ ਨੇ ਉਹ ਕੋਰਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਇਹਨਾਂ ਨੂੰ ਟੀਮ ਬਣਾ ਕੇ ਆਪਣੇ ਇੱਕ ਉਨ੍ਹਾਂ ਨੇ ਇੱਕ ਆਪਣਾ ਇੱਕ ਖੋਲ੍ਹਿਆ ਹੋਇਆ ਹੈ ਜਿਮ ਟਾਈਪ ਕਹਿ ਲਉ ਜਾਂ ਜਿੱਦਾਂ ਵੀ ਖੋਲ੍ਹਿਆ ਹੋਇਆ ਹੈ ਅਤੇ ਉਹਦੇ ਵਿੱਚ ਜਾ ਕੇ ਲੋਕ ਫੀਸ ਭਰ ਕੇ ਅਤੇ ਉੱਥੇ ਸਿੱਖਦੇ ਹਨ ਉਹਦੇ ਵਿੱਚ ਉਹ ਅਲੱਗ ਅਲੱਗ ਤਰ੍ਹਾਂ ਦੇ ਸਟੈਪ ਗਿੱਧਾ ਗੱਤਕਾ ਅਤੇ ਬੱਚਿਆਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਉਹ ਤਰੀਕੇ ਸਿਖਾਉਂਦੇ ਹਨ ਨਵੇਂ ਭੰਗੜੇ ਦੇ ਸਟੈਪ ਸਿਖਾ ਤਰੀਕੇ ਸਟੈਪ ਸਿਖਾਉਂਦੇ ਹਨ ਜਿਹਦੇ ਵਿੱਚ ਬੱਚੇ ਅੱਜ ਕੱਲ੍ਹ ਨਵੇਂ ਤੋਂ ਨਵੀਂ ਸ਼੍ਰੇਣੀਆਂ ਹੁੰਦੀਆਂ ਹਨ ਅਤੇ ਗੱਤਕਾ ਵੀ ਉਹਦੇ ਵਿੱਚ ਆ ਜਾਂਦਾ ਹੈ ਅਤੇ ਬ ਛੋਟੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਬਜ਼ੁਰਗ ਚਾਹੇ ਤੁਹਾਨੂੰ ਜਿਹੜੀ ਮਰਜ਼ੀ ਉਮਰ ਹੋਏ ਤੁਸੀਂ ਇਸ ਵਿੱਚ ਹਿੱਸਾ ਲੈ ਸਕਦੇ ਹੋ ਤੁਸੀਂ ਅੱਜ ਕੱਲ੍ਹ ਦੇਖਿਆ ਹੋਏਗਾ ਕਿ ਆਮ ਨਗਰ ਕੀਰਤਨ ਵਿੱਚ ਜਾਂ ਕਿਤੇ ਵੀ ਇਹ ਸਭ ਅੱਜ ਕੱਲ੍ਹ ਬਹੁਤ ਪ੍ਰਚਲਿਤ ਹੈ ਅਤੇ ਧੰਨਵਾਦ